ਛੇ ਮਈ ਉੱਨੀ ਸੌ ਚੁਰਾਨਵੇਂ ਪੰਦਰਾਂ ਅਗਸਤ ਉੱਨੀ ਸੌ ਸੰਤਾਲ਼ੀ ਪੰਦਰਾਂ ਮਾਰਚ ਦੋ ਹਜ਼ਾਰ ਇੱਕ ਛੱਬੀ ਜੁਲਾਈ ਦੋ ਹਜ਼ਾਰ ਚਾਰ ਇੱਕੀ ਜਨਵਰੀ ਦੋ ਹਜ਼ਾਰ ਤੇਈ